ਪੰਜਾਬ ਦੀ ਸਿਆਸੀ ਪ੍ਰਣਾਲੀ ਦੀ ਗੱਲ ਕਰੀਏ ਤਾਂ ਵੋਟਾਂ ਵੇਲੇ ਗੱਲ ਕੁਝ ਹੋਰ ਹੁੰਦੀ ਹੈ ਬਾਅਦ ਵਿੱਚ ਗੱਲ ਕੁਝ ਹੋਰ ਹੁੰਦੀ ਹੈ ਬਹੁਤ ਜ਼ਿਆਦਾ ਲੁਭਾਵਣੇ ਵਾਅਦੇ ਕੀਤੇ ਜਾਂਦੇ ਹਨ ਜੋ ਕਿ ਬਾਅਦ ਵਿੱਚ ਇੱਕ ਵੀ ਪੂਰਾ ਨਹੀਂ ਹੁੰਦਾ ਜਿਸ ਨਾਲ ਆਮ ਲੋਕਾਂ ਨੂੰ ਬਹੁਤ ਦਿੱਕਤ ਹੁੰਦੀ ਹੈ ਅਗਰ ਅਸੀਂ ਗੱਲ ਕਰੀਏ ਸਰਕਾਰ ਦੀ ਸਰਕਾਰ ਪਹਿਲਾਂ ਪਹਿਲਾਂ ਜਨਤਾ ਜਿਹੜੀ ਹੈ ਉਹ ਐੱਮ ਐੱਲ ਏ ਨੂੰ ਚੁਣਦੀ ਹੈ ਐੱਮ ਐੱਲ ਏ ਵੋਟਿੰਗ ਕਰਦੇ ਹਨ ਉਹ ਉਹ ਤੋਂ ਬਾਅਦ ਮੁੱਖ ਮੰਤਰੀ ਬਣਦਾ ਹੈ ਲੋਕਤੰਤਰ ਦੀ ਗੱਲ ਕਰੀਏ ਤਾਂ ਲੋਕ ਐੱਮ ਪੀ ਨੂੰ ਵੋਟਾਂ ਪਾਉਂਦੇ ਹਨ ਐੱਮ ਪੀ ਬਣਦੇ ਹਨ ਐੱਮ ਪੀ ਵੋਟਿੰਗ ਕਰਕੇ ਪ੍ਰਧਾਨ ਮੰਤਰੀ ਬਣਾਉਂਦੇ ਹਨ ਪ੍ਰਧਾਨ ਮੰਤਰੀ ਤੋਂ ਬਾਅਦ ਰਾਸ਼ਟਰਪਤੀ ਹੁੰਦਾ ਹੈ ਜੋ ਕਿ ਪ੍ਰਧਾਨ ਮੰਤਰੀ ਦੀ ਪਾਵਰ ਰਾਸ਼ਟਰਪਤੀ ਤੋਂ ਵੀ ਜ਼ਿਆਦਾ ਹੁੰਦੀ ਹੈ ਜੋ ਕਿ ਪ੍ਰਧਾਨ ਮੰਤਰੀ ਜ਼ਿਆਦਾ ਕੰਮ ਕਰਦਾ ਹੈ ਰਾਸ਼ਟਰਪਤੀ ਸੀਨੀਅਰ ਜ਼ਰੂਰ ਹੁੰਦਾ ਹੈ